ਖਾਸ ਸੱਭਿਆਚਾਰਕ ਅਭਿਆਸ ਇਹ ਹਨ ਕਿ ਜਦ ਵੀ ਅਸੀਂ ਪੂਜਾ ਦੇ ਦੌਰਾਨ ਮੰਦਿਰ ਜਾਂ ਗੁਰਦੁਆਰੇ ਜਾਂਦੇ ਹਨ ਅਤੇ ਅਸੀਂ ਬਿਲਕੁਲ ਹੀ ਸਿੱਧੇ ਅਤੇ ਸਿੰਪਲ ਪਹਿਰਾਵੇ ਵਿੱਚ ਸਾਨੂੰ ਮੰਦਿਰ ਜਾਂ ਗੁਰਦੁਆਰੇ ਜਾਣਾ ਚਾਹੀਦਾ ਹੈ ਅਤੇ ਆਪਣਾ ਸਿਰ ਹਮੇਸ਼ਾਂ ਢੱਕ ਕੇ ਹੱਥ ਜੋੜ ਕੇ ਹੀ ਉੱਥੇ ਪੂਜਾ ਕਰਨੀ ਚਾਹੀਦੀ ਹੈ ਇਹ ਕੁਝ ਖਾਸ ਸੱਭਿਆਚਾਰਕ ਅਭਿਆਸ ਹਨ ਜੋ ਅਸੀਂ ਵਿਸ਼ੇਸ਼ ਤੌਰ 'ਤੇ ਪੂਜਾ ਦੇ ਦੌਰਾਨ ਆਪਣਾਉਂਦੇ ਹਨ ਅਤੇ ਸਾਰਿਆਂ ਨੂੰ ਅਸੀਂ ਹੱਥ ਜੋੜ ਕੇ ਉੱਥੇ ਮਿਲਦੇ ਹਨ ਭਗਵਾਨ ਦੇ ਅੱਗੇ ਵੀ ਨਸਮਸਤਕ ਹੁੰਦੇ ਹਨ ਮੱਥਾ ਚੰਗੀ ਤਰ੍ਹਾਂ ਟੇਕਦੇ ਹਨ ਸਿਰ ਉੱਤੇ ਚੁੰਨੀ ਲੈ ਕੇ ਸਿੰਪਲ ਪਹਿਰਾਵੇ ਵਿੱਚ ਹੱਥ ਜੋੜ ਕੇ ਅਸੀਂ ਇਹਨਾਂ ਚੀਜ਼ਾਂ ਨੂੰ ਅਪਣਾਉਂਦੇ ਹਨ